ਹਾਂਜੀ ਬਿਲਕੁਲ ਮੈਂ ਜ਼ਮੈਟੋ ਜਾਂ ਸਵੀਗੀ ਵਰਗੀਆਂ ਫੂਡ ਡਿਲੀਵਰੀਜ਼ ਸੇਵਾਵਾਂ ਦੀ ਵਰਤੋਂ ਕੀਤੀ ਹੈ ਆਈ ਥਿੰਕ ਅੱਜ ਦੇ ਟਾਈਮ ਵਿੱਚ ਹਰ ਕੋਈ ਕਰਦਾ ਹੀ ਆ ਲੋਕ ਉਹ ਚੀਜ਼ ਕਿਉਂ ਛੱਡਣਗੇ ਜਿਹੜੀ ਉਹਨਾਂ ਦੀ ਜ਼ਿੰਦਗੀ ਦਾ ਥੋੜ੍ਹਾ ਰਹਿਣ ਸਹਿਣ ਦਾ ਤਰੀਕਾ ਆਸਾਨ ਬਣਾਵੇ ਜਮੈਟੋ ਤੋਂ ਜਾਂ ਸਵੀਗੀ ਤੋਂ ਆਪਾਂ ਔਨਲਾਈਨ ਡਿਲੀਵਰੀ ਮੰਗਵਾ ਸਕਦੇ ਹਾਂ ਘਰ ਆਪਾਂ ਨੂੰ ਘਰ ਬੈਠੇ ਬੈਠੇ ਮਿਲ ਜੇਗੀ ਆਪਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪਏਗੀ ਸੋ ਓਬਵੀਅਸਲੀ ਇਹ ਬਹੁਤ ਹੀ ਇਜੀ ਤਰੀਕਾ ਆਪਣੀ ਜ਼ਿੰਦਗੀ ਨੂੰ ਆਸਾਨ ਬਣਾਉਣ ਦਾ ਹਾਂ ਮੈਂ ਕਾਫੀ ਵਾਰੀ ਜਮੈਟੋ ਤੋਂ ਸਵੀਗੀ ਤੋਂ ਔਡਰ ਕੀਤੇ ਈ ਜਮੈਟੋ ਸਵੀਗੀ ਦੀਆਂ ਕਾਫੀ ਯੂ ਨੋ ਚੀਜ਼ਾਂ ਨੇ ਜਿਹੜੀਆਂ ਆਪਣੀ ਜ਼ਿੰਦਗੀ ਆਸਾਨ ਬਣਾਉਂਦੀਆਂ ਹੈ ਅਤੇ ਕੁਛ ਸੁਵਿਧਾਵਾਂ ਵੀ ਨੇ ਅਤੇ ਕੁਛ ਅਸੁਵਿਧਾਵਾਂ ਵੀ ਹੈਗੀਆਂ ਨੇ ਜਿੱਦਾਂ ਕਹਿੰਦੇ ਆ ਨਾ ਕਿ ਹਰ ਕੋਇਨ ਦੇ ਦੋ ਸਾਈਡਸ ਨੇ ਉਦਾਂ ਹੀ ਹਰ ਚੀਜ਼ ਦਾ ਨੈਗੇਟਿਵ ਅਤੇ ਪੋਜੀਟਿਵ ਦੋਨੋਂ ਚੀਜ਼ਾਂ ਹੈ ਹੀ ਹੈ ਹੁਣ ਅਸੁਵਿਧਾ ਦੀ ਅਗਰ ਗੱਲ ਕੀਤੀ ਜਾਵੇ ਤੇ ਹਾਂ ਅਗਰ ਮੰਨ ਲਓ ਕਿਸੇ ਦਿਨ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਆ ਅਤੇ ਫਿਰ ਆਪਣਾ ਖਾਣਾ ਪਹੁੰਚਣ ਨੂੰ ਟਾਈਮ ਲੱਗੇਗਾ ਜਾਂ ਬਾਏ ਚਾਂਸ ਕਿਤੇ ਅਚਾਨਕ ਬਹੁਤ ਜ਼ਿਆਦਾ ਟਰੈਫਿਕ ਆ ਤਾਂ ਫਿਰ ਵੀ ਆਪਣਾ ਖਾਣਾ ਪਹੁੰਚਣ 'ਚ ਟਾਈਮ ਲੱਗੂਗਾ ਅਗਰ ਆਪਾਂ ਨੂੰ ਸੱਚੀ ਬਹੁਤ ਜ਼ਿਆਦਾ ਹੀ ਭੁੱਖ ਲੱਗੀ ਹੋਈ ਤਾਂ ਫਿਰ ਜ਼ਿਆਦਾ ਭੁੱਖ ਕਰਕੇ ਆਪਣਾ ਮੂਡ ਖ਼ਰਾਬ ਹੋ ਸਕਦਾ ਹੈ ਮੂਡ ਕਰਕੇ ਆਪਣਾ ਸਾਰਾ ਦਿਨ ਵੀ ਖ਼ਰਾਬ ਜਾ ਸਕਦਾ ਹੈ ਹਾਂ ਅਗਰ ਸੁਵਿਧਾਵਾਂ ਦੀ ਗੱਲ ਕੀਤੀ ਜਾਵੇ ਤਾਂ ਫਿਰ ਇਹਨਾਂ ਦੀਆਂ ਫੂਡ ਡਿਲੀਵਰੀਜ਼ ਦੀਆਂ ਕਾਫੀ ਜ਼ਿਆਦਾ ਸੁਵਿਧਾਵਾਂ ਨੇ ਪਹਿਲੀ ਤਾਂ ਇਹੀ ਆ ਕਿ ਤੁਸੀਂ ਆਰਾਮ ਨਾਲ ਆਪਣਾ ਘਰੇ ਬਹਿ ਸਕਦੇ ਜੇ ਔਰ ਤੁਹਾਡਾ ਖਾਣਾ ਘਰ ਪਹੁੰਚ ਜੂਗਾ ਬਾਕੀ ਦੂਜੀ ਚੀਜ਼ ਆ ਟਾਈਮ ਆਪਣਾ ਸਮਾਂ ਬਹੁਤ ਜ਼ਿਆਦਾ ਬਚਦਾ ਹੈ ਅੱਜ ਦੇ ਟਾਈਮ ਵਿੱਚ ਤਾਂ ਹਰ ਕੋਈ ਚਾਹੁੰਦਾ ਕਿ ਉਹਨਾਂ ਦਾ ਸਮਾਂ ਬਚੇ ਹੀ ਬਚੇ ਕਿ ਉਹਨਾਂ ਨੂੰ ਆਪਣਾ ਸਮਾਂ ਕਿਤੇ ਬਰਬਾਦ ਨਾ ਕਰਨਾ ਪਵੇ ਆਉਣ ਜਾਣ ਵਿੱਚ ਜਿੱਦਾਂ ਕਹਿੰਦੇ ਆ ਨਾ ਕਿ ਟਾਈਮ ਇਜ਼ ਮਨੀ ਅਤੇ ਓਵੀਅਸਲੀ ਅੱਜ ਦੇ ਟਾਈਮ ਵਿੱਚ ਤਾਂ ਟਾਈਮ ਦੀ ਬਹੁਤ ਹੀ ਜ਼ਿਆਦਾ ਵੈਲਿਊ ਆ ਸੋ ਹਾਂ ਸੁਵਿਧਾਵਾਂ ਅਸੁਵਿਧਾਵਾਂ ਦੋਨੋਂ ਚੀਜ਼ਾਂ ਹੈ ਹੀ ਹੈ